ਹਾਂਜੀ ਨਮਸਕਾਰ ਮੈਮ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਮੈਮ ਤੁਸੀਂ ਸਾਨੂੰ ਖਰਚਾ ਦੱਸੋ ਕਿੰਨਾ ਅਤੇ ਇਹ ਕਿੰਨੇ ਦਿਨ ਦਾ ਟ੍ਰਿਪ ਹੈ ਮੈਮ ਤਿੰਨ ਦਿਨ ਦਾ ਅਤੇ ਖਾਣਾ ਪੀਣਾ ਮਿਲੇਗਾ ਨਾ ਖੂਬ ਖੁੱਲ੍ਹਾ ਅਤੇ ਮੈਮ ਥੋੜ੍ਹਾ ਬੱਚਾ ਸ਼ਰਾਰਤੀ ਹੈ ਇਹਦਾ ਜਰਾ ਧਿਆਨ ਰੱਖਣਾ ਪੈਣਾ ਤੁਹਾਨੂੰ ਬੱਚਾ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਸ਼ਰਾਰਤੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਪੈਸੇ ਮੈਮ ਫਿਰ ਅਸੀਂ ਕੱਲ੍ਹ ਕਾਕੇ ਹੱਥ ਹੀ ਭੇਜ ਦੇਵਾਂਗੇ ਠੀਕ ਹੈ ਹਾਂਜੀ ਠੀਕ ਹੈ ਮੈਮ